ਹੈਲੋ ਹਾਂਜੀ ਫਲਿੱਪਕਾਰਟ ਤੋਂ ਗੱਲ ਕਰ ਰਹੇ ਹੋ ਮੈਂ ਤੁਹਾਨੂੰ ਤੁਹਾਡੀ ਸਾਈਡ ਦੇ ਉੱਪਰੋਂ ਇੱਕ ਪਿਉਮਾ ਦੀ ਜੈਕਟ ਬਾਏ ਕੀਤੀ ਸੀ ਮੈਂ ਦੱਸਣਾ ਚਾਹੁੰਦਾ ਸੀ ਕਿ ਤੁਹਾਡੀ ਜੈਕਟ ਦਾ ਫੈਬਰਿਕ ਬਹੁਤ ਸੋਹਣਾ ਹੈ ਬਹੁਤ ਹੀ ਵਧੀਆ ਹੈ ਅਤੇ ਮੈਨੂੰ ਜਿਹੜੀ ਹੈ ਤੁਹਾਡੀ ਜੈਕਟ ਜਿਹੜੀ ਹੈ ਬਹੁਤ ਹੀ ਪਸੰਦ ਆਈ ਹੈ ਅਤੇ ਜੈਕਟ ਦੀ ਤਾਂ ਫਿਟਿੰਗ ਹੀ ਬਹੁਤ ਵਧੀਆ ਸੀ ਅਤੇ ਲੈਂਥ ਵਾਈਸ ਵੀ ਮੈਨੂੰ ਬਹੁਤ ਹੀ ਵਧੀਆ ਲੱਗੀ ਹੈ ਇਹਦਾ ਕਲਰ ਹੀ ਬੜਾ ਸੋਹਣਾ ਲੱਗਾ ਮੈਨੂੰ ਜਿਹੜੀ ਇਹ ਜੈਕਟ ਸੀ ਬੜੀ ਬਲਿਊ ਅਤੇ ਲਾਈਟ ਫਰੋਜੀ ਕਲਰ ਸੀ ਅਤੇ ਮੈਨੂੰ ਬਹੁਤ ਹੀ ਸੋਹਣਾ ਲੱਗਾ ਇਹਦੀ ਫਿਟਿੰਗ ਬਹੁਤ ਜ਼ਿਆਦਾ ਫੈਬਰਿਕ ਵੀ ਬਹੁਤ ਵਧੀਆ ਸੀ ਕਿਉਂਕਿ ਮੈਂ ਇਹੋ ਜਿਹੀ ਜੈਕਟ ਬਾਜ਼ਾਰ ਵਿੱਚ ਖਰੀਦਣ ਗਿਆ ਸੀ ਲੇਕਿਨ ਮੈਨੂੰ ਕਿਤੋਂ ਵੀ ਇਹ ਜੈਕਟ ਨਹੀਂ ਮਿਲੀ ਅਤੇ ਮੈਂ ਇਹ ਦੱਸ ਕੇ ਲੈ ਕੇ ਖਰੀਦ ਕੇ ਬਹੁਤ ਹੀ ਖੁਸ਼ ਹਾਂ ਕਿਉਂਕਿ ਮੈਂ ਇਹਨੂੰ ਇੱਕ ਦੋ ਵਾਰ ਧੋ ਕੇ ਵੀ ਦੇਖਿਆ ਹੈ ਇਹਦਾ ਕਲਰ ਵੀ ਫੇਡ ਨਹੀਂ ਹੋਇਆ ਅਤੇ ਇਹ ਮੈਨੂੰ ਬਹੁਤ ਹੀ ਪਸੰਦ ਲੱਗੀ ਹੈ ਮੇਰੇ ਹੋਰ ਵੀ ਯਾਰਾਂ ਦੋਸਤਾਂ ਮਿੱਤਰਾਂ ਨੇ ਬਹੁਤ ਹੀ ਪਸੰਦ ਕੀਤੀ ਹੈ ਤੇ ਮੈਂ ਤੁਹਾਡਾ ਬਹੁਤ ਹੀ ਧੰਨਵਾਦੀ ਹਾਂ ਇਹ ਤੁਹਾਡਾ ਪ੍ਰੋਡਕਟ ਲੈ ਕੇ